ਲੰਬੀ ਬਾਇਕਿੰਗ ਯਾਤਰਾ ਜਾਂ ਟੂਰ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਬਾਈਕ ਆ ਉਹਨੂੰ ਧਿਆਨ ਦੇ ਨਾਲ ਪੂਰਾ ਉਹਦੀ ਸਰਵਿਸ ਕਰਾਵਾਂ ਕਰਾਵਾਂਗੇ ਸਰਵਿਸ ਕਰਵਾਉਣ ਤੋਂ ਬਾਅਦ ਵਧੀਆ 'ਚ ਉਹਦੇ ਟਾਇਰ ਵਗੈਰਾ ਦੇਖਾਂਗੇ ਵੀ ਹਾਂ ਜ਼ਿਆਦਾ ਘਸੇ ਤਾਂ ਨਹੀਂ ਕਢ ਕੱਢ ਜਾਣਗੇ ਦੋਵੇਂ ਟਾਇਰ ਦੇਖਾਂਗੇ ਉਹਦੇ ਜੇ ਪੈਂਦੇ ਹੋਏ ਟਾਇਰ ਬਦਲਾ ਕੇ ਬਿਲਕੁਲ ਉਹਦੀ ਹਵਾ ਵਗੈਰਾ ਸਾਰਾ ਕੁਛ ਚੈੱਕ ਕਰਕੇ ਬਾਈਕ ਪੂਰੀ ਤਿਆਰ ਕਰਾਂਗੇ ਵੀ ਰਾਸਤੇ ਦੇ ਵਿੱਚ ਵੀ ਕਿਤੇ ਬੰਦ ਨਾ ਹੋ ਜਾਵੇ ਕਿਉਂਕਿ ਮਸ਼ੀਨਰੀ ਆ ਕਿਤੇ ਵੀ ਧੋਖਾ ਦੇ ਸਕਦੀ ਆ ਸੋ ਪਹਿਲਾਂ ਸਭ ਤੋਂ ਪਹਿਲਾਂ ਉਹਦੀ ਪੂਰੀ ਤਰਾਂ ਜਾਂਚ ਪੜਤਾਲ ਕਰਾਂਗੇ ਵੀ ਹਾਂ ਵੀ ਸਹੀ ਚੱਲ ਰਹੀ ਆ ਉਹਦੇ ਤੋਂ ਬਾਅਦ ਕੋਈ ਜ਼ਰੂਰੀ ਚੀਜ਼ਾਂ ਜਿਹੜੀਆਂ ਆ ਰਾਸਤੇ ਦੇ ਵਿੱਚ ਕੰਮ ਆ ਸਕਦੀਆਂ ਹਾਂ ਉਹ ਜਿਹੜੀਆਂ ਇੱਕ ਬੈਗ ਇੱਕ ਕਿੱਟ ਤਿਆਰ ਕਰਾਂਗੇ ਜਿਵੇਂ ਕਿ ਰੋਜ਼ ਆਪਾਂ ਨੂੰ ਬਰੱਸ਼ ਬੁਰਸ਼ ਕਰਨ ਦੇ ਲਈ ਸਵੇਰ ਨੂੰ ਦੰਦ ਸਾਫ਼ ਕਰਨ ਦੇ ਲਈ ਜਾਂ ਆਪਾਂ ਦੋ ਤਿੰਨ ਬੋਤਲਾਂ ਪਾਣੀ ਦੀਆਂ ਵੀ ਰੱਖਾਂਗੇ ਜ਼ਰੂਰ ਵੀ ਰਾਸਤੇ ਦੇ ਵਿੱਚ ਹੋ ਸਕਦਾ ਕਿਤੇ ਪਾਣੀ ਨਾ ਮਿਲੇ ਪਾਣੀ ਆਪਾਂ ਨੂੰ ਪੀਣ ਦੇ ਕੰਮ ਵੀ ਆਵੇ ਫਿਰ ਆਪੇ ਹੀ ਇਹੋ ਜਿਹਾ ਲਾਈਟ ਖਾਣਾ ਵੀ ਨਾਲ ਲੈ ਸਕਦੇ ਹਾਂ ਬਰੈਡ ਵਗੈਰਾ ਵੀ ਜਿਹੜਾ ਜੇ ਕਿਤੇ ਮਨ ਲਓ ਆਪਾਂ ਰਾਸਤੇ ਦੇ ਇਹੋ ਜਿਹੀ ਜਗ੍ਹਾ 'ਤੇ ਚਲੇ ਗਏ ਵੀ ਰਸਤੇ 'ਚ ਕੋਈ ਖਾਣ ਨੂੰ ਚੀਜ਼ ਨਹੀਂ ਮਿਲੀ ਸੋ ਆਪਣਾ ਜਿਹੜਾ ਆਪਾਂ ਖਾ ਕੇ ਗੁਜ਼ਾਰਾ ਕੁਝ ਕੁਝ ਨਾ ਕੁਝ ਕਰ ਸਕਦੇ ਹਾਂ ਵੀ ਹਾਂ ਵੀ ਜੇ ਭੁੱਖ ਲੱਗ ਗਈ ਆ ਜ਼ਰੂਰਤ ਆ ਜੇ ਕਿਤੇ ਆਪਾਂ ਫਸ ਗਏ ਹਾਂ ਰਾਹ 'ਤੇ ਇਹਨਾ ਆਪਾਂ ਖਿਆਲ ਰੱਖ ਸਕੀਏ ਕਿ ਆਪਾਂ ਜਿਹੜਾ ਖਾ ਕੇ ਆਪਣਾ ਵਧੀਆ ਫਿਰ ਨਾਲ ਇੱਕ ਰੇਨਕੋਟ ਦਾ ਵੀ ਜ਼ਰੂਰ ਰੱਖਾਂਗੇ ਕਿ ਰਾਹ ਦੇ ਵਿੱਚ ਜੇ ਬਾਰਿਸ਼ ਆ ਜਾਂਦੀ ਮੀਹ ਪੈ ਜਾਂਦਾ ਅਤੇ ਰੇਨਕੋਟ ਵੀ ਜਿਹੜਾ ਆਪਣੇ ਵਾਸਤੇ ਜ਼ਰੂਰੀ ਆ ਵੀ ਰੇਨਕੋਟ ਜੇ ਆਪਣੇ ਕੋਲ ਹੋਊਗਾ ਆਪਾਂ ਆਪਣੇ ਸਮਾਨ ਜਿਹੜਾ ਕੱਪੜੇ ਜਿਹੜੇ ਆ ਉਹ ਗਿੱਲੇ ਨਹੀਂ ਹੋਣ ਹੋਣ ਤੋਂ ਬਚ ਜਾਣਗੇ ਰੇਨਕੋਟ ਦੇ ਨਾਲ ਸੋ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਹੋਰ ਵੀ ਕਈ ਚੀਜ਼ਾਂ ਜਿਹਨਾਂ ਦਾ ਆਪਾਂ ਧਿਆਨ ਰੱਖ ਸਕਦੇ ਹਾਂ ਸੋ ਬਸ ਇਹ ਕੁਝ ਚੀਜ਼ਾਂ ਜਿਹੜੀਆਂ ਦਿਮਾਗ ਦੇ ਵਿੱਚ ਸੀਗੀਆਂ